ਮੈਂ ਅਜਿਹੀ ਖੇਡ ਵੀ ਖੇਡੀ ਹੈ ਜਿਸ ਨਾਲ ਮੈਂ ਬਹੁਤ ਹੀ ਮਤਲਬ ਜ਼ਿਆਦਾ ਖੁਸ਼ ਰਹਿ ਸਕਦੀ ਹਾਂ ਅਤੇ ਭਾਵਨਾਤਮਕ ਤੌਰ 'ਤੇ ਬਹੁਤ ਹੀ ਪ੍ਰਭਾਵਸ਼ਾਲੀ ਜਾਂ ਅਰਥਪੂਰਨ ਲੱਗਦੀ ਹੈ ਉਹ ਖੇਡ ਬਾਸਕਿਟਬੋਲ ਹੈ ਜੋ ਕਿ ਮੈਂ ਜਦੋਂ ਵੀ ਉਸ ਨੂੰ ਖੇਡਦੀ ਹਾਂ ਤਾਂ ਮੇਰਾ ਮਨ ਬਹੁਤ ਹੀ ਜ਼ਿਆਦਾ ਵਧੀਆ ਖੁਸ਼ ਰਹਿੰਦਾ ਹੈ ਮੈਨੂੰ ਬਹੁਤ ਹੀ ਸਕੂਨ ਮਿਲਦਾ ਹੈ ਅਤੇ ਉਸ ਖੇਡ ਨੂੰ ਖੇਡ ਕੇ ਮੈਂ ਹਰ ਟਾਈਮ ਵਧੀਆ ਫੀਲ ਕਰਦੀ ਹਾਂ ਜਿੱਦਾਂ ਕਿ ਮੈਨੂੰ ਕਦੀ ਵੀ ਕੋਈ ਪਰੇਸ਼ਾਨੀ ਹੋਈ ਜਾਂ ਫਿਰ ਮੈਂ ਕਦੀ ਵੀ ਕਿਸੀ ਵੀ ਦੁੱਖ ਵਿੱਚ ਹੋਵਾਂ ਤਾਂ ਮੈਂ ਉਸ ਖੇਡ ਨੂੰ ਖੇਡ ਲਵਾਂ ਤਾ ਮੇਰਾ ਮਨ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਅਤੇ ਮੈਂ ਕੁਛ ਵੀ ਬਿਨਾਂ ਸੋਚੇ ਸਮਝੇ ਸਾਰੀਆਂ ਗੱਲਾਂ ਪਿੱਛੇ ਛੱਡ ਕੇ ਉਸ ਖੇਡ ਨੂੰ ਖੇਡ ਕੇ ਬਹੁਤ ਹੀ ਜ਼ਿਆਦਾ ਵਧੀਆ ਫੀਲ ਕਰਦੀ ਹਾਂ ਅਤੇ ਉਸ ਨਾਲ ਮਤਲਬ ਮੇਰਾ ਸਰੀਰ ਤੰਦਰੁਸਤ ਰਹਿੰਦਾ ਹੈ ਜਿੱਦਾਂ ਕਿ ਕਈ ਵਾਰ ਮੈਂ ਬਿਮਾਰ ਵਗੈਰਾ ਹੋਵਾਂ ਜਾਂ ਫਿਰ ਕੁਛ ਵੀ ਮੈਂ ਉਸ ਖੇਡ ਨੂੰ ਖੇਡ ਕੇ ਬਹੁਤ ਹੀ ਵਧੀਆ ਫੀਲ ਕਰਦੀ ਹਾਂ ਅਤੇ ਉਸ ਨਾਲ ਮੇਰੀ ਕਈ ਬਿਮਾਰੀਆਂ ਵੀ ਦੂਰ ਹੋ ਜੀਆਂ ਜਿੱਦਾਂ ਪਹਿਲੇ ਬਹੁਤ ਹੀ ਮੋਟੀ ਵੀ ਹੁੰਦੀ ਸੀ ਅਤੇ ਖੇਡ ਖੇਡ ਕੇ ਮੇਰਾ ਸਰੀਰ ਵੀ ਫਿਟ ਰਹਿੰਦਾ ਹੈ ਔਰ ਬਾਕੀ ਹੋਰ ਵੀ ਇੱਦਾਂ ਦੀਆਂ ਕਈ ਯਾਦਾਂ ਜੁੜੀਆਂ ਨੇ ਇਸ ਖੇਡ ਨਾਲ ਮੇਰੀਆਂ ਇਸ ਨਾਲ ਮੈਨੂੰ ਬਹੁਤ ਹੀ ਭਾਵਨਾਤਮਕ ਤੌਰ 'ਤੇ ਪ੍ਰਭਾਵਸ਼ਾਲੀ ਜਾਂ ਅਰਥਪੂਰਨ ਲੱਗਦੀ ਹੈ ਧੰਨਵਾਦ